ਅੱਜ ਦੇ ਸਮੇਂ ਦੇ ਵਿੱਚ ਡਿਜ਼ੀਟਲ ਪੇਮੈਂਟ ਦਾ ਬਹੁਤ ਜ਼ਿਆਦਾ ਫਾਇਦਾ ਹੈ ਡਿਜ਼ੀਟਲ ਪੇਮੈਂਟ ਦੇ ਨਾਲ ਤੁਹਾਨੂੰ ਮੈਨੂੰ ਵੀ ਇਸ ਬਾਰੇ ਬਾਅਦ 'ਚ ਪਤਾ ਲੱਗਿਆ ਕਿ ਕੱਲ੍ਹ ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਕੋਈ ਜ਼ਰੂਰੀ ਪੈਸੇ ਦੇਣ ਜਾਣਾ ਸੀਗਾ ਅਤੇ ਜਦੋਂ ਮੈਂ ਉਸਨੂੰ ਪੈਸੇ ਦੇਣ ਜਾ ਰਿਹਾ ਸੀ ਤਾਂ ਤਾਂ ਮੈਨੂੰ ਰਸਤੇ ਵਿੱਚ ਇੱਕ ਮੇਰਾ ਹੋਰ ਯਾਰ ਮਿਲਿਆ ਉਹ ਕਹਿੰਦਾ ਕਿੱਥੇ ਚੱਲਿਆ ਮੈਂ ਕਿਹਾ ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਪੇਮੈਂਟ ਦੇਣ ਚੱਲਿਆ ਅਤੇ ਉਸ ਨੇ ਮੈਨੂੰ ਸਮਝਾਇਆ ਬੈਠ ਕਹਿੰਦਾ ਉਹਨੇ ਮੈਨੂੰ ਇਹ ਗੂਗਲ ਐਪ ਦੇ ਬਾਰੇ ਦੱਸਿਆ ਜੋ ਮੈਂ ਡਾਊਨਲੋਡ ਕਰੀ ਅਤੇ ਉਸ ਰਾਹੀਂ ਮੇਰਾ ਕੰਮ ਇੰਨਾ ਸੌਖਾ ਹੋ ਗਿਆ ਕਿ ਹੁਣ ਮੈਂ ਆਪਣੇ ਔਨਲਾਈਨ ਸਾਰੇ ਕੰਮ ਜਿਵੇਂ ਕਿ ਬੱਚਿਆਂ ਦੀਆਂ ਫੀਸਾਂ ਭਰਨੀਆਂ ਉਹ ਵੀ ਮੈਂ ਗੂਗਲ ਐਪ ਤੋਂ ਭਰ ਸਕਦਾ ਹਾਂ ਅਤੇ ਜਿਵੇਂ ਕਿ ਗੈਸ ਸਲੰਡਰ ਦੀ ਫੀਸ ਪੇ ਕਰਨੀ ਬਿਜਲੀ ਦਾ ਬਿੱਲ ਭਰਨਾ ਅਤੇ ਮੋਬਾਇਲ ਦੇ ਰੀਚਾਰਜ ਕਰਨੀ ਅ ਵਾਟਰ ਸਪਲਾਈ ਦੀ ਸਪ ਪੇਮੈਂਟ ਕਰਨੀ ਜਾਂ ਜਿਵੇਂ ਬਾਜ਼ਾਰ ਜਾਣਾ ਤੁਹਾਨੂੰ ਕੈਸ਼ ਚੱਕਣ ਦੀ ਲੋੜ ਨਹੀਂ ਤੁਸੀਂ ਆਪਣਾ ਜਿਵੇਂ ਮਰਜ਼ੀ ਖਾਲੀ ਹੱਥ ਜਾ ਰਹੇ ਜਿਸ 'ਚ ਤੁਹਾਡਾ ਫੋਨ ਤੁਹਾਡੇ ਕੋਲ ਹੋਣਾ ਚਾਹੀਦਾ ਫੋਨ ਤੁਸੀਂ ਲਿਜਾ ਕੇ ਉੱਥੇ ਜੋ ਮਰਜ਼ੀ ਤੁਸੀਂ ਆਪਣੀ ਸ਼ੋਪਿੰਗ ਕਰੋ ਗੂਗਲ ਐਪ ਜਾਂ ਜੋ ਵੀ ਪੇਟੀਐੱਮ ਜਾਂ ਜਿਸੇ ਵੀ ਐਪ ਤੁਸੀਂ ਯੂਜ਼ ਕਰਦੇ ਹੋ ਉਸ ਨਾਲ ਤੁਸੀਂ ਪੇਮੈਂਟ ਕਰ ਦਿਉ ਅੱਜ ਕੱਲ੍ਹ ਤਾਂ ਤੁਸੀਂ ਜੇ ਮੰਨ ਲਉ ਸਬਜ਼ੀ ਵੀ ਖਰੀਦਣੀ ਹੈ ਤਾਂ ਸਬਜ਼ੀ ਵਾਲੇ ਕੋਲ ਵੀ ਸਕੈਨਰ ਲੱਗੇ ਵੇ ਨੇ ਉੱਥੇ ਵੀ ਤੁਹਾਨੂੰ ਕੈਸ਼ ਲਿਜਾਣ ਦੀ ਲੋੜ ਨਹੀਂ ਜਿੰਨੀ ਵੀ ਤੁਹਨੂੰ ਲੋੜ ਹੈ ਚਾਹੇ ਦਸ ਵੀਹ ਪੰਜਾਹ ਸੌ ਦੋ ਸੌ ਜੋ ਵੀ ਆਪਣੀ ਸਬਜ਼ੀ ਲੈਣੀ ਹੈ ਲੈ ਸਕਦੇ ਹੋ ਅਤੇ ਕੱਲ੍ਹ ਜੋ ਮੈਨੂੰ ਇੱਕ ਹੋਰ ਵਧੀਆ ਲੱਗਿਆ ਵੀ ਜਿਵੇਂ ਹੁਣ ਅੱਜ ਕੱਲ੍ਹ ਫਰੂਟ ਦੀ ਦੁਕਾਨਾਂ ਨੇ ਉਹਨਾਂ ਨੇ ਵੀ ਫਾਸਟ ਫੂਡ ਵਾਲਿਆਂ ਨੇ ਵੀ ਆਪਣੇ ਸਕੈਨਰ ਰੱਖੇ ਨੇ ਜੇ ਤੁਸੀਂ ਦਸ ਵੀਹ ਰੁਪਏ ਦੇ ਗੋਲ ਗੱਪੇ ਖਾਣੇ ਆ ਤਾਂ ਤੁਸੀਂ ਨਾਲ ਦੀ ਨਾਲ ਉਹਨੂੰ ਸਕੈਨ ਕਰਕੇ ਉਹਦੀ ਪੇਮੈਂਟ ਤੁਸੀਂ ਕਰ ਸਕਦੇ ਹੋ ਅਤੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਇੱਕ ਤਾਂ ਦੋ ਨੰਬਰ ਦੀ ਕਮਾਈ ਹੈ ਜਿਹੜੀ ਉਹ ਹੋਣੋ ਹਟ ਗਈ ਆ ਅਤੇ ਸਰਕਾਰ ਦੀ ਜਿੰਨਾ ਵੀ ਟੈਕਸ ਆ ਸਰਕਾਰ ਦੇ ਖਾਤੇ 'ਚ ਜਾਂਦਾ ਹੈ ਸਰਕਾ ਅਤੇ ਇਸ ਚੀਜ਼ ਦਾ ਸਰਕਾਰ ਨੂੰ ਅਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ